ਸਤਿ ਸ਼੍ਰੀ ਅਕਾਲ ਮੇਰਾ ਨਾਮ ਗਗਨਪ੍ਰੀਤ ਕੌਰ ਹੈ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਜਿਵੇਂ ਕਿ ਛੋਟੇ ਮੋਟੇ ਕਾਰੋਬਾਰ ਬਾਰੇ ਪੁੱਛਿਆ ਜਾ ਰਿਹਾ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਠਾਨਕੋਟ ਵਿੱਚ ਲੇਡੀਜ ਆਪਣੇ ਘਰ ਬਟੀਕ ਖੋਲ੍ਹੇ ਹਨ ਅਤੇ ਉਹ ਸਟਿਚਿੰਗ ਵਗੈਰਾ ਕਰਦੀਆਂ ਹਨ ਅਤੇ ਉਹ ਸੂਟ ਵਗੈਰਾ ਅਤੇ ਪਲਾਜੋ ਵਗੈਰਾ ਸਿਉਂਦੀਆਂ ਵਾ ਅਤੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਹੋ ਜਾਂਦੇ ਛੋਟੇ ਮੋਟੇ ਕਾਰੋਬਾਰ ਵਿੱਚ ਉਹ ਸਟੀਚਿੰਗ ਕਰਦੀਆਂ ਨੇ ਕੱਪੜਿਆਂ ਦੀ ਅਤੇ ਅਤੇ ਮੇਕਅਪ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਵਾ ਕੰਮ ਅਤੇ ਇੱਥੇ ਲੋਕਾਂ ਨੇ ਮੇਕਅਪ ਵੀ ਸਿੱਖ ਰਹੇ ਆ ਬੱਚੇ ਨਵੇਂ ਨਵੇਂ ਜਿੱਦਾਂ ਹੈ ਵਾ ਉਹ ਮੇਕਅਪ ਵਗੈਰਾ ਸਿੱਖਦੇ ਹਨ ਅਤੇ ਮੈਂ ਵੀ ਮੇਰਾ ਵੀ ਮੇਕਅਪ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ ਅਤੇ ਮੈਂ ਵੀ ਮੇਕਅਪ ਬਾਰੇ ਕਲਾਸਾਂ ਜਾਂ ਕੋਚਿੰਗ ਲੈਣੀ ਆ ਅਤੇ ਮੈਂ ਮੇਕਅਪ ਸਕਿੰਨ 'ਤੇ ਲੇਅ ਲਾਟ ਵਗੈਰਾ ਸਾਰੀ ਕੋਚਿੰਗ ਲੈਣੀ ਆ ਅਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਅਤੇ ਮੈਂ ਵੀ ਕਿਤੇ ਜੋਬ ਅਪਲਾਈ ਕਰਨੀ ਆ ਅਤੇ ਮੈਂ ਹਜੇ ਥੋੜ੍ਹਾ ਬਹੁਤਾ ਬੇਸਿਕ ਮੇਕਅਪ ਵਗੈਰਾ ਸਿੱਖਿਆ ਵਾ ਅਤੇ ਅਤੇ ਥੋੜ੍ਹਾ ਬਹੁਤਾ ਸਕਿੰਨ ਦਾ ਬੇਸਿਕ ਸਿੱਖਿਆ ਅਤੇ ਹੇਅਰਸ ਦਾ ਮੈਂ ਹਜੇ ਸਿੱਖਣਾ ਵਾ ਅਤੇ ਮਤਲਬ ਹੇਅਰ ਦਾ ਵੀ ਮੈ ਮੈਂ ਥੋੜ੍ਹਾ ਬੇਸਿਕ ਹੀ ਸਿੱਖੀ ਸਿੱਖਿਆ ਵਾ ਅਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਸਿੱਖ ਕੇ ਅਤੇ ਮੈਂ ਮੇਕਅਪ ਬਾਰੇ ਅਪਲਾਈ ਕਰਨਾ ਵਾ ਉੱਥੇ ਜਾ ਕੇ ਸਲੂਨ ਵਿੱਚ ਅਤੇ ਉੱਥੇ ਜਾ ਕੇ ਮੈਂ ਆਪਣਾ ਡੈਮੋ ਵਗੈਰਾ ਦੇ ਕੇ ਆਉਣਾ ਵਾ ਅਤੇ ਫਿਰ ਮੈਨੂੰ ਉੱਥੇ ਜਾ ਕੇ ਮੈਂ ਜੋਬ ਲੱਗ ਜਾਣਾ ਵਾ